ਇੱਥੇ ਲੋਕ ਬਹੁਤ ਕਿਸਮਾਂ ਦੀਆਂ ਫਸਲਾਂ ਬੀਜਦੇ ਹੈ ਜਿਵੇਂ ਕਣਕ ਮੱਕੀ ਮਾਂਹ ਛੋਲੇ ਸਾਰਾ ਕੁਛ ਬੀਜਦੇ ਹੈ ਅਤੇ ਪਸ਼ੂ ਮੱਝ ਮੱਝਾਂ ਗਾਵਾਂ ਬੱਕਰੀਆਂ ਸਭ ਰੱਖਦੇ ਹੈ ਇੱਥੇ